ਹੈਲੋ ਸਤਿ ਸ਼੍ਰੀ ਅਕਾਲ ਸਰ ਤੁਸੀਂ ਮੈਕਸ ਬੀਮਾ ਯੋਜਨਾ ਤੋਂ ਬੋਲਦੇ ਹੋ ਨਾ ਮੈਂ ਤੁਹਾਡੇ ਤੋਂ ਮਤਲਬ ਬੀਮਾ ਕਰਵਾਇਆ ਸੀ ਐਲ ਆਈ ਸੀ ਦੇ ਥਰੂ ਹੈ ਨਾ ਅਤੇ ਮਤਲਬ ਸਰ ਮੇਰਾ ਨਾ ਐਕਚੁਲੀ ਵੇਟ ਬਹੁਤ ਜ਼ਿਆਦਾ ਵੱਧ ਗਿਆ ਸੀਗਾ ਅਤੇ ਮੈਂ ਆਪਦਾ ਨਾ ਵੇਟ ਲੂਸ ਕਰਨਾ ਅਤੇ ਉਹਦੇ ਰਿਕਾਰਡਿੰਗ ਮੈਂ ਤੁਹਾਨੂੰ ਪੁੱਛਣਾ ਸੀਗਾ ਕਿ ਇਹ ਕਿੱਥੇ ਨਾ ਮਤਲਬ ਕਿ ਸ ਮੁਕਤਸਰ ਵਿੱਚ ਇੱਕ ਫਿਟਨੈਸ ਦਾ ਕੈਂਪ ਲੱਗ ਰਿਹਾ ਅਤੇ ਕੀ ਉਹ ਉਹਦੇ ਅੰਡਰ ਆਉਂਦਾ ਅਤੇ ਪਲੀਜ਼ ਤੁਸੀਂ ਮੈਨੂੰ ਦੱਸ ਦਿਓ ਅਤੇ ਮਤਲਬ ਮੈਂ ਆਪਦਾ ਵੇਟ ਲੂਸ ਕਰਨਾ ਹਾਂਜੀ ਠੀਕ ਹੈ ਸਰ ਓਕੇ ਤੁਸੀਂ ਮੈਨੂੰ ਕਿਹਾ ਸੀ ਜੇ ਕੋਈ ਮਤਲਬ ਕਿ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਕਾਲ ਕਰ ਸਕਦੇ ਹੋ ਹੈ ਨਾ ਹਾਂਜੀ ਠੀਕ ਹੈ ਸਰ ਓਕੇ ਥੈਂਕ ਯੂ ਜੇ ਕੋਈ ਹੋਰ ਵੀ ਪ੍ਰੋਬਲਮ ਆਈ ਤਾਂ ਹਾਂਜੀ ਸਰ ਕੋਈ ਗੱਲ ਨਹੀਂ ਮੈਂ ਤੁਹਾਨੂੰ ਪੁੱਛ ਲਊਗੀ ਹਾਂਜੀ ਠੀਕ ਹੈ ਥੈਂਕ ਯੂ ਸਰ